ਸਤਿ ਸ਼੍ਰੀ ਅਕਾਲ ਮੈਮ ਮੈਂ ਇੰਡੀਆ ਗੇਟ ਤੋਂ ਮੈਂ ਇੰਡੀਆ 'ਚ ਘੁੰਮਣ ਆਇਆ ਹਾਂ ਅਤੇ ਮੈਨੂੰ ਦੱਸੋ ਮੈਂ ਕਿੱਥੇ ਰਹਿ ਸਕਦਾ ਹਾਂ ਅਤੇ ਟਰਾਂਸਪੋਰਟ ਟ੍ਰਾਂਪੋਟੇਸ਼ਨ ਕਿਵੇਂ ਕਰ ਸਕਦਾਂ ਦੱਸੋ ਮੈਂ ਇਨ੍ਹਾਂ ਨੂੰ ਕਿਹਾ ਵੀ ਕਰ ਸਕਦਾਂ

ਮੈਂ ਇਹਨਾਂ ਨੂੰ ਕਿਵੇਂ ਅਵੇਲ ਕਰ ਸਕਦਾਂ ਮੈਂ ਇਹਨਾਂ ਨੂੰ ਕਿਵੇਂ ਅਵੀਲ ਕਰ ਸਕਦਾਂ ਓਕੇ ਅਤੇ ਟ੍ਰਾਂਸਪੋਰਟੇਸ਼ਨ ਦੀ ਕੋਈ ਓਪਸ਼ਨ ਦੇ ਦਓ ਓਕੇ ਇਹ ਸਭ ਮੇਰੇ ਬਜਟ 'ਚ ਆ ਜਾਣਗੇ ਇਹ ਸਭ ਮੇਰੇ ਬਜਟ ਵਗੈਰਾ 'ਚ ਆ ਜਾਣਗੇ ਓਕੇ ਇਹ ਸਭ ਸੇਫਲੀ ਆ ਓਕੇ ਬਾਕੀ ਸਭ ਸਕਿਓ ਸਕਿਓਰਡ ਆ ਓਕੇ ਥੈਂਕਸ ਮੈਮ ਓਕੇ ਥੈਂਕ ਯੂ ਮੈਮ